ਭਾਰਤ ਵਿੱਚ ਮੇਰਾ ਮਨਪਸੰਦ ਰਾਜ ਪੰਜਾਬ ਹੈ ਕਿਉਂਕਿ ਇੱਥੇ ਮੈਨੂੰ ਘੁੰਮਣਾ ਬਹੁਤ ਵਧੀਆ ਲੱਗਦਾ ਇੱਥੇ ਇਤਿਹਾਸਿਕ ਗੁਰਦੁਆਰੇ ਹਨ ਜਿਤਨੇ ਵੀ ਆਪਣਾ ਸਾਡੇ ਗੁਰੂ ਸਾਹਿਬਾਨ ਹੋਏ ਆ ਜ਼ਿਆਦਾਤਰ ਪੰਜਾਬ ਦੇ ਹੀ ਹੋਏ ਹਨ ਇੱਥੇ ਜਿੰਨੇ ਵੀ ਗੁਰਦੁਆਰੇ ਬਹੁਤ ਵਧੀਆ ਹਨ ਜਿਸ ਤਰ੍ਹਾਂ ਆਪਣਾ ਸ਼੍ਰੀ ਹਰਿਮੰਦਰ ਸਾਹਿਬ ਹੈ ਉੱਥੇ ਆਪਣਾ ਘੁੰਮਣ ਜਾਂਦੇ ਹਾਂ ਆਪਾਂ ਨੂੰ ਵਧੀਆ ਚੀਜ਼ਾਂ ਬਾਰੇ ਪਤਾ ਲੱਗਦਾ ਸਿੱਖੀ ਬਾਰੇ ਸਾਨੂੰ ਇਤਿਹਾਸ ਬਾਰੇ ਪਤਾ ਲੱਗਦਾ ਹੈ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਬਾਰੇ ਦੱਸਦੇ ਹਾਂ ਅਤੇ ਇੱਦਾਂ ਹੀ ਅਸੀਂ ਆਪਣਾ ਤਲਵੰਡੀ ਸਾਬੋ ਜਨ ਦਮਦਮਾ ਸਾਹਿਬ ਜਾਂਦੇ ਹਾਂ ਉੱਥੇ ਵੀ ਆਪਾਂ ਨੂੰ ਸਾਨੂੰ ਸਿੱਖ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਅਤੇ ਹੋਰ ਵੀ ਜਿ ਜਿਸ ਤਰ੍ਹਾਂ ਅਸੀਂ ਅਨੰਦਪੁਰ ਸਾਹਿਬ ਜਾਂਦੇ ਹਾਂ ਉੱਥੇ ਸਾਨੂੰ ਪਹਾੜੀਆਂ ਦਾ ਆਨੰਦ ਮਹਿਸੂਸ ਹੁੰਦਾ ਹੈ ਅਤੇ ਉਹਨਾਂ ਉੱਥੇ ਵੀ ਸਿੱਖ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਅਤੇ ਇੱਦਾਂ ਅਸੀਂ ਘੁੰਮ ਫਿਰ ਕੇ ਪੰਜਾਬ 'ਚ ਬਹੁਤ ਸਾਰੀਆਂ ਥਾਵਾਂ ਦੇਖਦੇ ਹਾਂ ਤਾਂ ਜੋ ਸਾਰੀਆਂ ਚੀਜ਼ਾਂ ਬਾਰੇ ਸਾਨੂੰ ਪਤਾ ਲੱਗ ਸਕੇ ਜਿੰਨੇ ਇਤਿਹਾਸਿਕ ਗੁਰਦੁਆਰੇ ਹਨ ਪੰਜਾਬ 'ਚ ਜ਼ਿਆਦਾਤਰ ਹਨ ਜਿਤਨਾ ਬਾਰੇ ਸਾਨੂੰ ਅਲੱਗ ਅਲੱਗ ਸ ਹਰੇਕ ਗੁਰਦੁਆ ਹਰ ਗੁਰਦੁਆਰਾ ਸਾਹਿਬ ਦੀ ਹਿਸਟਰੀ ਅਲੱਗ ਅਲੱਗ ਹੈ ਤਾਂ ਜੋ ਸਾਨੂੰ ਉਹਨਾਂ ਦੀ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਬਕਾਇਦਾ ਸਾਨੂੰ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਗੈਰਾ ਜੋ ਵੀ ਸੇਵਾਦਾਰ ਹੁੰਦੇ ਹਨ ਉਹ ਸਾਨੂੰ ਇਹਨਾਂ ਬਾਰੇ ਜਾਣਕਾਰੀ ਦਿੰਦੇ ਹਨ ਅਤੇ ਅਸੀਂ ਹੋਰ ਬਾਰੇ ਜਿੱਥੇ ਜਾਂਦੇ ਹਾਂ ਪਠਾਨਕੋਟ ਸਾਹਿਬ ਜਿੱਥੇ ਆਪਣਾ ਮਿਨੀ ਗੋਆ ਕਿਹਾ ਜਾਂਦਾ ਹੈ ਉੱਥੇ ਜਾਂਦੇ ਹਾਂ ਉੱਥੇ ਵੀ ਆਪਾਂ ਨੂੰ ਘੁੰਮਣ ਦਾ ਅਲੱਗ ਮਜ਼ਾ ਆਪਾਂ ਉੱਥੇ ਫੈਮਿਲੀ ਨਾਲ ਜਾਂਦੇ ਹਾਂ ਅਤੇ ਫੈਮਿਲੀ ਨਾਲ ਜਾਣ ਦਾ ਮਜ਼ਾ ਉੱਥੇ ਅਲੱਗ ਹੈ ਕਿਉਂਕਿ ਉੱਥੇ ਵੀ ਆਪਾਂ ਨੂੰ ਇੱਕ ਗੋਆ ਦਾ ਮਹਿਸ ਆਨੰਦ ਮਹਿਸੂਸ ਹੁੰਦਾ ਹੈ